ਤਰਨ ਤਾਰਨ ਦੇ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਮੁੱਤ ਮੁੱਖ ਉਦਯੋਗ ਜਿਹੜਾ ਹੈ ਉਹ ਖੇਤੀਬਾੜੀ ਹੈ ਔਰ ਖੇਤੀਬਾੜੀ ਹੀ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹ ਖੇਤੀਬਾੜੀ ਕਰਦੇ ਹਨ ਔਰ ਉਹ ਖੇਤੀਬਾੜੀ ਕਿਸਾਨਾਂ ਦੇ ਸਿਰ ਦੇ ਉੱਤੇ ਹੀ ਤਾਂ ਸ਼ਹਿਰ ਵਸਿਆ ਹੋਇਆ ਹੈ ਅਤੇ ਤਰਨ ਤਾਰਨ ਦਾ ਸ਼ਹਿਰ ਜਿਹੜਾ ਹੈ ਉਹਨਾਂ ਦੀਆਂ ਦੁਕਾਨਾਂ ਦੇ ਲੋਕ ਜ਼ਿਆਦਾਤਰ ਕੰਮ ਕਰਦੇ ਹਨ ਬਿਜਨਸ ਨੇ ਲੋਕਾਂ ਦੇ ਆਪਣੇ ਜਿਹਦੇ ਵਿੱਚ ਆਮ ਜਿਸ ਤਰ੍ਹਾਂ ਹਰ ਸ਼ਹਿਰ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਹਨ ਮਿਠਾਈ ਦੀਆਂ ਦੁਕਾਨਾਂ ਇਹ ਵੀ ਕੰਮ ਕਰਦੇ ਨੇ ਲੋਕ ਜਿਹੜੇ ਬਿਜਨਸਮੈਨ ਲੋਕ ਆ ਅਤੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਜਿਹੜਾ ਉਹਨਾਂ ਦਾ ਉਦਯੋਗ ਹੈ ਉਹ ਖੇਤੀਬਾੜੀ ਹੈ ਕਈ ਲੋਕ ਐਸੇ ਹਨ ਜਿਹਨਾਂ ਦੀਆਂ ਬਹੁਤ ਜ਼ਿਆਦਾ ਜ਼ਮੀਨਾਂ ਨੇ ਉੱਥੇ ਕੰਮ ਕਰਨ ਤੋਂ ਬਾਅਦ ਉਹ ਥੋੜ੍ਹੀ ਦੇਰ ਬਾਅਦ ਬਾਅਦ 'ਚੋਂ ਆਪਣੀਆਂ ਦੁਕਾਨਾਂ ਖੋਲ੍ਹਦੇ ਹਨ ਅਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਸ਼ਹਿਰ ਨੇ ਉਹ ਪਿੰਡਾਂ ਦੇ ਸਿਰ 'ਤੇ ਹੀ ਵਸੇ ਹੋਏ ਨੇ ਅਤੇ ਕਿਸਾਨ ਲੋਕ ਆ ਕੇ ਆਪਣੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਸ਼ਹਿਰਾਂ 'ਚੋਂ ਲੈ ਕੇ ਜਾਂਦੇ ਹਨ ਜਿਹਨਾਂ ਦੇ ਕਰਕੇ ਸ਼ਹਿਰੀ ਵੀ ਆਪਣੇ ਰੋਜ਼ ਰੋਟੀ ਕਮਾ ਰਹੇ ਹਨ ਤੋ ਮੇਨ ਮੁੱਦਾ ਇਹੀ ਆਉਂਦਾ ਹੈ ਕਿ ਜਿਹੜਾ ਸਾਡਾ ਇੱਥੇ ਦਾ ਮੁੱਖ ਉਦਯੋਗ ਹੈ ਉਹ ਖੇਤੀਬਾੜੀ ਔਰ ਬਿਜਨਸ ਹੈ